ਹੈਲੋ ਓ ਪੰਜਾਬ ਵਿੱਚ ਖੇਤੀਬਾੜੀ ਦਾ ਜੋ ਉਤਪਾਦਨ ਬਹੁਤ ਜ਼ਰੂਰੀ ਹੈ ਜੀ ਕਿਉਂਕਿ ਇਹਦੇ ਨਾਲ ਹੀ ਅਸੀਂ ਮਤਲਬ ਸਾਡਾ ਸਾਰਾ ਇਹਦੇ 'ਤੇ ਹੀ ਡਿਪੈਂਡ ਹੋ ਰਿਹਾ ਅਸੀਂ ਸਾਰੇ ਜੇ ਖੇਤੀਬਾੜੀ ਨਾ ਹੋਵੇ ਤਾਂ ਅਸੀਂ ਕੁਛ ਵੀ ਖਾ ਪੀ ਨਹੀਂ ਸਕਦੇ ਜਿੱਦਾਂ ਕੋਈ ਸ ਕਿਸਾਨ ਸਭ ਕੁਛ ਸਾਰੀਆਂ ਫਸਲਾਂ ਉਹ ਉਗਾਉਂਦਾ ਅਸੀਂ ਇਸ ਚੀਜ਼ਾਂ ਦਾ ਉਤਪਾਦ ਜਿਹੜਾ ਕਰਦੇ ਹਾਂ ਅਤੇ ਅਸੀਂ ਬਾਹਰਲੇ ਮੁਲਕਾਂ ਨੂੰ ਵੀ ਐਕਸਪੋਟ ਮਤਲਬ ਭੇਜਦੇ ਹਾਂ ਉੱਥੋਂ ਸਾਨੂੰ ਫੋਰਨ ਕਰੰਸੀ ਆਉਂਦੀ ਹੈ ਉਸ ਕਰੰਸੀ ਦੇ ਨਾਲ ਸਾਡਾ ਮਤਲਬ ਉਹ ਜਿਹੜੀ ਬਾਹਰ ਦੀ ਕਰੰਸੀ ਆ ਸਾਨੂੰ ਸਾਨੂੰ ਇਹਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਮਤਲਬ ਜ਼ਿਆਦਾ ਆਉਂਦੀ ਹੈ ਅਤੇ ਹਾਂ ਹਾਂ ਹਾਂ ਬਿਲਕੁਲ ਬਿਲਕੁਲ ਅਤੇ ਇਹਦੇ ਤਾਂ ਇਸ ਕਰਕੇ ਅਸੀਂ ਅਲੱਗ ਅਲੱਗ ਫਸਲਾਂ ਜਿੱਦਾਂ ਕਪਾਹ ਹੁੰਦੀ ਹੈ ਅਤੇ ਮੱਕੀ ਹੈ ਅਸੀਂ ਬਾਹਰ ਭੇਜਦੇ ਹਾਂ ਉਹਨਾਂ ਨਾਲ ਸਾਨੂੰ ਓ ਮਤਲਬ ਉਹ ਬਾਹਰ ਦੀ ਕਰੰਸੀ ਸਾਡੇ ਕੋਲ ਆਉਂਦੀ ਹੈ ਠੀਕ ਹੈ ਜੀ

ਹਾਂ ਇਹ ਬਹੁਤ ਵਧੀਆ ਠੀਕ ਹੈ